ਹੈਲੋ ਸਤਿ ਸ੍ਰੀ ਅਕਾਲ ਮੈਮ ਹਾਂਜੀ ਹਾਂਜੀ ਮੈਮ ਪਰਚੇਜ ਵੀ ਕਰ ਲੈਂਦੇ ਹਾਂ ਅਤੇ ਸੇਲ ਵੀ ਕਰ ਲੈਂਦੇ ਹਾਂ ਪਰ ਉਹਦੀ ਸਾਡੀ ਮਤਲਬ ਕੁਝ ਹੁੰਦੇ ਨੇ ਅਸੀਂ ਮਤਲਬ ਜਦੋਂ ਇਹ ਬੱਚਿਆਂ ਦੇ ਇਗਜਾਮਜ਼ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਸਿਰਫ ਮੰਨਥ ਬਾਅਦ ਹੀ ਅਸੀਂ ਲੈਂਦੇ ਹਾਂ ਉਹ ਤੋਂ ਬਾਅਦ ਅਸੀਂ ਨਹੀਂ ਲੈਂਦੇ ਉਹ ਬੁੱਕਸ ਓਕੇ ਇੱਕ ਤਾਂ ਬੁੱਕ ਦੀ ਕੰਡੀਸ਼ਨ 'ਤੇ ਹੁੰਦਾ ਕਿ ਬੁੱਕ ਦੀ ਕੰਡੀਸ਼ਨ ਕਿਦਾਂ ਦੀ ਪਈ ਆ ਜ਼ਿਆਦਾ ਫਟੀ ਹੋਈ ਤਾਂ ਨਹੀਂ ਆ ਜ਼ਿਆਦੇ ਲਾਈਨਸ ਤਾਂ ਨਹੀਂ ਆ ਉਹਦੇ ਉੱਤੇ ਓਕੇ ਮਤਲਬ ਉਹ ਤਾਂ ਤੁਹਾਨੂੰ ਇੱਕ ਵਾਰ ਤਾਂ ਬੁੱਕ ਦਿਖਾਣੀ ਹੀ ਪਉਗੀ ਨਾ ਇੱਦਾਂ ਤਾਂ ਅਸੀਂ ਤੁਹਾਨੂੰ ਪ੍ਰਾਈਜ ਵੀ ਨਹੀਂ ਦੱਸ ਪਾਵਾਂਗੇ ਕਿ ਅਸੀਂ ਕਿੰਨਾ ਕੁ ਪ੍ਰਾਈਜ ਦੇ ਦਿਆਂਗੇ ਤੁਹਾਨੂੰ

ਨਹੀਂ ਐਟ ਲੀਸਟ ਮਤਲਬ ਫਾਈਵ ਈਅਰ ਦਾ ਹੁੰਦਾ ਜੇ ਫਾਈਵ ਈਅਰਸ ਤੋਂ ਪੁਰਾਣਾ ਫਿਰ ਉਹ ਅਸੀਂ ਨਹੀਂ ਲਵਾਂਗੇ ਜੇ ਫਾਈਵ ਈਅਰਸ ਤੋਂ ਪਹਿਲਾਂ ਪਹਿਲਾਂ ਦਾ ਉਹ ਅਸੀਂ ਲੈ ਲੈਂਦੇ ਹੁੰਦੇ ਹਾਂ ਮਤਲਬ ਨਈਆਂ ਤਾਂ ਨਹੀਂ ਅਸੀਂ ਦੇ ਸਕਦੇ ਜੇ ਸਾਡੇ ਕੋਲ ਮਤਲਬ ਉਸ ਦੇ ਰਿਗਾਰਡਿੰਗ ਹੀ ਪੁਰਾਣੀਆਂ ਪਈਆਂ ਹੋਣਗੀਆਂ ਤਾਂ ਅਸੀਂ ਤੁਹਾਨੂੰ ਪੁਰਾਣੀਆਂ ਹੀ ਦੇ ਦਿਆਂਗੇ ਬਟ ਨਈ ਨਹੀਂ ਦੇ ਦੇ ਪਾਵਾਂਗੇ ਨਾ ਹਾਂਜੀ ਅਸੀਂ ਪੁਰਾਣੀਆਂ ਦੇ ਦਾਂਗੇ ਅਤੇ ਜੇ ਤੁਸੀਂ ਮਤਲਬ ਕਿੰਨੇ ਟਾਈਮ ਲਈ ਚਾਹੀਦੀਆਂ ਹੋਣਗੀਆਂ ਤੁਹਾਨੂੰ ਹਾਂਜੀ ਰੈਂਟਲ ਸਿਸਟਮ ਵੀ ਹੁੰਦਾ ਮਤਲਬ ਕਈ ਬੱਚੇ ਓਕੇ ਮਤਲਬ ਕਈ ਬੱਚੇ ਤਾਂ ਹੁੰਦੇ ਨੇ ਜੋ ਸਿਕਸ ਮੰਥਲੀ ਲੈ ਕੇ ਜਾਂਦੇ ਨੇ ਕਈ ਟੂ ਵਾਲੇ ਵੀ ਹੁੰਦੇ ਨੇ ਤਾਂ ਹੁਣ ਇਹਦੇ ਅਲੱਗ ਅਲੱਗ ਚਾਰਜਸ ਪੇ ਹੁੰਦੇ ਨੇ ਬਟ ਇੱਦਾਂ ਵੀ ਹੁੰਦਾ ਨਾ ਫਿਰ ਤੁਹਾਨੂੰ ਉਹ ਬੁੱਕ ਵਾਪਸ ਕਰਕੇ ਜਾਣੀ ਹੀ ਪਉਗੀ ਕਈ ਬੱਚੇ ਹੁੰਦੇ ਨੇ ਜੋ ਵਾਪਸ ਹੀ ਨਹੀਂ ਕਰਦੇ ਬਾਅਦ ਚੋਂ ਰੈਂਟ ਮੈਮ ਉਹ ਤਾਂ ਮੰਥ ਦੇ ਅਕੋਰਡਿੰਗ ਹੁੰਦਾ ਸਾਡਾ ਵੀ ਜਿੰਨੇ ਕੁ ਮੰਥ ਉਹਨਾਂ ਨੇ ਰੱਖਣੀ ਹੈ ਜੇ ਫਾਈਵ ਹੰਡਰਡ ਦੀ ਬੁੱਕ ਹੈ ਤਾਂ ਹੰਡਰਡ ਰੁਪੀਸ ਪੈ ਜਾਂਦੇ ਹੁੰਦੇ ਨੇ ਮੰਥਲੀ

ਮੈਂ ਸ਼ਾਮ ਨੂੰ ਮੈਂ ਛੇ ਵਜੇ ਤੱਕ ਹਾਂਜੀ ਓਕੇ